ਮੈਂ ਆਪਣੀ ਗਾਈਕੀ ਦੀ ਤਕਨੀਕੀ ਦਾ ਅਭਿਆਸ ਆਪਣੇ ਗੁਰੂ ਜੀ ਨਾਲ ਕਰਦੀ ਹਾਂ ਮੇਰੇ ਗੁਰੂ ਜੀ ਨੇ ਹੀ ਮੈਨੂੰ ਸਾਰੀ ਤਕਨੀਕਾਂ ਬਾਰੇ ਸਿਖਾਇਆ ਹੈ ਅਤੇ ਜਿੱਥੇ ਜਿੱਥੇ ਉਹ ਅਭਿਆਸ ਕਰਨ ਜਾਂਦੇ ਹਨ ਅਤੇ ਮੈਂ ਉਹਨਾਂ ਨਾਲ ਉਸ ਉਹਨਾਂ ਦੇ ਕੰਮ 'ਤੇ ਅਭਿਆਸ ਕਰਦੀ ਹੋਈ ਸਿੱਖਦੀ ਹਾਂ